ਹੈਲੋ ਸਰ ਤੁਸੀਂ ਸਵੀਗੀ ਵਾਲਿਆਂ ਤੋਂ ਬੋਲਦੇ ਜੋ ਅਸੀਂ ਨਾ ਤੁਹਾਡੇ ਜਿਹੜਾ ਚਾਂਦ ਰੈਸਟੋਰੈਂਟ ਹੈਗਾ ਹੈ ਨਾ ਉੱਥੋਂ ਕੁਛ ਅਸੀ ਖਾਣ ਵਾਸਤੇ ਵਧੀਆ ਆਈਟਮ ਮੰਗਵਾਉਣੀਆਂ ਸੀ ਮੈਂ ਨਾ ਦੂਸਰਾ ਅਸੀਂ ਆਪਣੇ ਦੋਸਤ ਤੋਂ ਸੁਣਿਆ ਸੀ ਕਿ ਉੱਥੋਂ ਬਹੁਤ ਵਧੀਆ ਪਕਵਾਨ ਖਾਣ ਵਾਸਤੇ ਮਿਲਦੇ ਆ ਮਠਿਆਈ ਵੀ ਬਹੁਤ ਵਧੀਆ ਤੁਹਾਡੇ ਰੈਸਟੋਰੈਂਟ ਦੀ ਉਹ ਦੂਸਰੇ ਰੈਸਟੋਰੈਂਟਾਂ ਤੋਂ ਨਹੀਂ ਮਿਲਦੀ ਹੈਗੀ ਉਹਦੇ ਨਾਲ ਦੀ ਮਠਿਆਈ ਜਿਹੜੀ ਤੁਹਾਡੇ ਰੈਸਟੋਰੈਂਟ ਤੋਂ ਮਿਲਦੀ ਆ ਬਹੁਤ ਵਧੀਆ ਆਈਟਮਾਂ ਨਮਕੀਨ ਵਿੱਚ ਕਿਹੜੀ ਕਿਹੜੀ ਆਈਟਮ ਆ ਤੁਹਾਡੇ ਰੈਸਟੋਰੈਂਟ ਵਿੱਚ ਅਤੇ ਮਠਿਆਈ ਵਿੱਚ ਕਿਹੜੀ ਕਿਹੜੀ ਵਧੀਆ ਆਈਟਮ ਆ ਤੁਸੀਂ ਸਾਰੀਆਂ ਦੱਸ ਦਿਓ ਅਤੇ ਕੀ ਰੇਟ ਆ ਇਹਨਾਂ ਦਾ ਅਤੇ ਮਠਿਆਈ ਦਾ ਕੀ ਰੇਟ ਹੈਗਾ ਹੈ ਵਧੀਆ ਜਿਹੜੀ ਨਮਕੀਨ ਵਾਲੀ ਆਈਟਮ ਆ ਉਹਦਾ ਕੀ ਰੇਟ ਹੈਗਾ ਹੈ ਤੁਹਾਡੇ ਰੈਸਟੋਰੈਂਟ ਬਾਰੇ ਬਹੁਤ ਸੁਣਿਆ ਹੈ ਤੁਹਾਡੇ ਮਸਾਲੇਦਾਰ ਪਕਵਾਨ ਬਹੁਤ ਵਧੀਆ ਹੁੰਦੇ ਨੇ ਬਹੁਤ ਹੀ ਟੇਸਟ ਹੁੰਦੇ ਨੇ ਤੁਹਾਡੇ ਰੈਸਟੋਰੈਂਟ ਵਿੱਚੋਂ ਕੁਛ ਆਈਟਮਾਂ ਮੰਗਵਾਉਣੀਆਂ ਵਾਂ ਅਤੇ ਦੱਸੋ ਕੀ ਕੀ ਮਿਲਦਾ ਵਧੀਆ ਤੋਂ ਵਧੀਆ ਆਈਟਮ ਬਾਰੇ ਸਾਨੂੰ ਦੱਸੋ